ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੀ ਜ਼ਰੂਰ ਮਿਲ ਜਾਣਗੇ ਜੀ ਜ਼ਰੂਰ ਮਿਲ ਜਾਣਗੇ ਕਿੰਨੇ ਦਿਨ ਲਈ ਤੁਹਾਨੂੰ ਕਮਰਾ ਚਾਹੀਦਾ ਜੀ ਮਿਲ ਜੂਗਾ ਕਮਰਾ ਤੁਹਾਨੂੰ ਅਟੈਚ ਚਾਹੀਦਾ ਹੈਗਾ ਕਿ ਇਕੱਲਾ ਇਕੱਲਾ ਕਮਰਾ ਚਾਹੀਦਾ ਹੈ ਜੀ ਠੀਕ ਹੈ ਹੋਰ ਹਾਂਜੀ ਤੁਹਾਨੂੰ ਹੋਮ ਸਰਵਿਸ ਮਿਲੇ ਰੂਮ ਸਰਵਿਸ ਮਿਲੇਗੀ ਟਵੈਂਟੀ ਫੋਰ ਅਵਰਜ਼ ਤੁਸੀਂ ਅਗਰ ਕੁਛ ਖਾਣ ਲਈ ਆਪਣੇ ਕਮਰੇ 'ਚ ਮੰਗਵਾਉਣਾ ਚਾਹੁੰਦੇ ਹੋ ਤੁਹਾਨੂੰ ਉਹ ਵੀ ਸਰਵਿਸ ਮਿਲੇਗੀ ਬਟ ਉਹਦੇ ਲਈ ਤੁਹਾਨੂੰ ਫਿਫਟੀ ਪ ਪ੍ਰਸੈਂਟ ਚਾਰਜ ਹੋਵੇਗਾ ਓਨਲੀ ਮਤਲਬ ਪੰਦਰ੍ਹਾਂ ਪ੍ਰਸੈਂਟ ਚਾਰਜ ਹੋਵੇਗਾ ਅਗਰ ਤੁਸੀਂ ਆਪਣੇ ਕਮਰੇ 'ਚ ਹੀ ਬਹਿ ਕੇ ਲੰਚ ਕਰਨਾ ਚਾਹੁੰਦੇ ਹੈ ਜਾਂ ਡਿਨਰ ਚੌਵੀ ਘੰਟੇ ਹੀ ਮਤਲਬ ਉਪਲਬਧ ਹੈ ਦੋ ਹਜ਼ਾਰ ਰੁਪਏ ਦੋ ਹਜ਼ਾਰ ਰੁਪਏ ਇੱਕ ਦਿਨ ਦਾ ਹਾਂਜੀ ਉਰੇ ਬਹੁਤ ਵੱਡਾ ਪਾਰਕਿੰਗ ਏਰੀਆ ਹੈਗਾ ਗਾਰਡਨ ਵੀ ਹੈਗਾ ਏ ਨਹੀਂ ਜੀ ਪਾਰਕਿੰਗ ਏਰੀਆ ਫ੍ਰੀ ਹੈ ਠੀਕ ਹੈ ਜੀ